ਪੰਜਾਬ ਵਿੱਚ ਪ੍ਰਮੁੱਖ ਸਿਆਸੀ ਨੇਤਾ ਦੇ ਪਾਰਟੀਆਂ ਹਨ ਹਰ ਪਾਰਟੀ ਦੇ ਵੱਖ ਵੱਖ ਨੇਤਾ ਹਨ ਵੱਖ ਪਾਰਟੀਆਂ ਆਮ ਆਦਮੀ ਬੀ ਜੇ ਪੀ ਕਾਂਗਰਸ ਅਕਾਲੀ ਦਲ ਅਤੇ ਬੀ ਐੱਸ ਪੀ ਇਹ ਵੀ ਪਾਰਟੀ ਹਨ ਪੀ ਐਸ ਐੱਸ ਦਾ ਨੇਤਾ ਕਪਿਲ ਮਿਸ਼ਰਾ ਸੁਨੀਲ ਜਾਖੜ ਨਰਿੰਦਰ ਮੋਦੀ ਅਮਿਤ ਸ਼ਾਹ ਇਹ ਹਨ ਇਸ ਦੇ ਕੰਮ ਦੇਸ਼ ਦੀ ਸੇਵਾ ਕਰਨਾ ਕਾਂਗਰਸ ਦੇ ਨਾਲ ਦੇ ਨੇਤਾ ਅਮਰਿੰਦਰ ਸਿੰਘ ਹਨ ਅਤੇ ਉਹ ਸਮਾਜਿਕ ਨਿਆਂ ਆਰਥਿਕ ਵਿਕਾਸ ਗਰੀਬੀ ਨੂੰ ਦੂਰ ਕਰਦੇ ਹਨ ਲੋਕਾਂ ਦੀ ਸਿਹਤ ਵੱਲੋਂ ਧਿਆਨ ਦਿੰਦੇ ਹਨ ਅਤੇ ਆਮ ਆਦਮੀ ਪਾਰਟੀ ਦਾ ਨੇਤਾ ਭਗਵੰਤ ਮਾਨ ਹੈ ਅਤੇ ਇਹ ਸਿੱਖਿਆ ਸਮਾਜ ਸੁਧਾਰ ਸਾਫ਼ ਪਾਣੀ ਦਾ ਧਿਆਨ ਰੱਖਦੇ ਹਨ ਬਹੂ ਜਨ ਸਮਾਜ ਦੀ ਪਾਰਟੀ ਦੇ ਨੇਤਾ ਸੁਰਜੀਤ ਸਿੰਘ ਅਤੇ ਦੇਸ਼ ਦੇ ਮੁੱਖ ਹਿੱਸੇ ਹਨ ਉਹ ਲੋਕਾਂ ਨੂੰ ਉਤਸ਼ਾਹ ਦਿੰਦੇ ਹਨ ਤੇ ਅਤੇ ਲੋਕ ਦੇ ਭਲਾਈ ਦੇ ਬਹੁਤ ਕੰਮ ਕਰਦੇ ਹਨ